ਮੈਨੂੰ ਬਾਈਕ ਚਲਾਉਣਾ ਬਹੁਤ ਹੀ ਪਸੰਦ ਹੈ ਅਤੇ ਇ ਇਹ ਮੈਂ ਰੋਜ਼ਾਨਾ ਚਲਾਉਣਾ ਪਸੰਦ ਕਰਦਾ ਹਾਂ ਇਸ ਦੇ ਨਾਲ ਮੈਂ ਘਰ ਦੇ ਕਈ ਸਾਰੇ ਕੰਮ ਕਰ ਲੈਂਦਾ ਹਾਂ ਬਾਈਕ ਬਾਈਕ ਚਾਹੇ ਦੂਰ ਜਾਣਾ ਹੋਵੇ ਜਾਂ ਨੇੜੇ ਜਾਣਾ ਹੋਵੇ ਮੈਂ ਬਾਈਕ ਨਾਲ ਉਹ ਸਾਰੇ ਕੰਮ ਕਰ ਲੈਂਦਾ ਹਾਂ ਚਾਹੇ ਬਾਜ਼ਾਰੋਂ ਕੋਈ ਸਮਾਨ ਲਿਆਉਣਾ ਹੋਵੇ ਜਾਂ ਕਿਸੇ ਨਾਲ ਘੁੰਮਣ ਜਾਣਾ ਹੋਵੇ ਜਾਂ ਕਿਸੇ ਨੂੰ ਲੈਣ ਜਾਣਾ ਹੋਵੇ ਮੈਂ ਮੋਟਰਸਾਈਕਲ ਲੈ ਕੇ ਉਹਨਾਂ ਨੂੰ ਲੈ ਵੀ ਆਉਂਦਾ ਹਾਂ ਸਮਾਨ ਵੀ ਖਰੀਦ ਆਉਂਦਾ ਹਾਂ ਅਤੇ ਇਹ ਕਰਨ ਨਾਲ ਮੈਨੂੰ ਬਹੁਤ ਹੀ ਪਸੰਦ ਅਤੇ ਮੇਰਾ ਦਿਲ ਲੱਗਾ ਰੈ ਰਹਿੰਦਾ ਹੈ ਬਾਈਕ ਚਲਾਉਣਾ ਮੈਂ ਆਪਣੇ ਭਰਾ ਕੋਲ ਭਰਾ ਕੋਲੋਂ ਸਿੱਖੀ ਸੀ ਅਤੇ ਉਹਨਾਂ ਨੇ ਮੈਨੂੰ ਬਹੁਤ ਸਾਰੇ ਸਾਜ਼ੋ ਸਮਾਨ ਬਾਰੇ ਵੀ ਦੱਸਿਆ ਸੀ ਕਿ ਮੋਟਰ ਬਾਈਕ ਦੀ ਕ ਕਿੱਦਾਂ ਕਦਰ ਕੀ ਕੀਤੀ ਜਾਂਦੀ ਹੈ ਅਤੇ ਕਿੱਦਾਂ ਉਹਦੀ ਦੇਖਭਾਲ ਕੀਤੀ ਜਾਂਦੀ ਹੈ ਮੋਟ ਬਾਈਕ ਨੂੰ ਹਮੇਸ਼ਾਂ ਇਹ ਪੈਟਰੋਲ ਲੱਗਦਾ ਹੈ ਅਤੇ ਉਸ ਦੇ ਕੁਝ ਸਾਜ਼ੋ ਸਮਾਨ ਵੀ ਹਨ ਜਿਵੇਂ ਕਿ ਕਲੱਚ ਬ੍ਰੇਕ ਗੇਅਰ ਆਦਿ ਅਤੇ ਮੇਰੇ ਨਾਲ ਕੁਝ ਐਸੇ ਵੀ ਭ ਮੇਰੇ ਨਾਲ ਕੁਝ ਇਹੋ ਜਿਹੇ ਮਨ ਅਸਫਲਤਾ ਅਨੁਭਵ ਵੀ ਮੈਂ ਕੀਤੀ ਹੈ ਮੋ ਬਾਈਕ 'ਚ ਜਿਵੇਂ ਕਿ ਮੈਂ ਆਪਣੇ ਦੋਸਤ ਨਾਲ ਕਿਤੇ ਬਾਹਰ ਜਾ ਰਿਹਾ ਸੀ ਘੁੰਮਣ ਲਈ ਅਤੇ ਮੇਰੀ ਅਚਾਨਕ ਹੀ ਮੇਰਾ ਮੇਰੀ ਬਾਈਕ ਖਰਾਬ ਹੋਣ ਕਾਰਨ ਮੈਂ ਮੈਨੂੰ ਉਹ ਕੰਮ ਵੀ ਛੱਡਣਾ ਪਿਆ ਅਤੇ ਮੈਂ ਮੇਰਾ ਦਿਲ ਉੱਥੇ ਹੀ ਉਦਾਸ ਹੋ ਗਿਆ ਅਤੇ ਇੱਕ ਵਾਰੀ ਤਾਂ ਇੰਝ ਹੋਇਆ ਮੇਰੇ ਨਾਲ ਕਿ ਮੇਰਾ ਮੇਰੀ ਬਾਈਕ ਅਚਾਨਕ ਹੀ ਕਿਸੇ ਮੋੜ 'ਤੇ ਆਣ ਖਰਾਬ ਹੋ ਗਈ ਅਤੇ ਜਿਸ ਕਾਰਨ ਮੈਂ ਆਪਣੇ ਬਜ਼ੁਰਗ ਦਾਦਾ ਜੀ ਨੂੰ ਹਸਪਤਾਲ ਨਹੀਂ ਲੈ ਜਾ ਸਕਿਆ ਅਤੇ ਉਹਦੇ ਜਿਹੜੀ ਜਿੱਥੇ ਸੱਟ ਲੱਗੀ ਸੀ ਅਤੇ ਉਹਨਾਂ ਨੂੰ ਆਟੋ ਕਰਕੇ ਜਾਣਾ ਪਿਆ ਅਤੇ ਮੈਨੂੰ ਇਹ ਬਹੁਤ ਹੀ ਮਾੜਾ ਲੱਗਿਆ ਇੰਝ ਹੀ ਕੁਝ ਅਨੁਭਵ ਮੈਂ ਬਹੁਤ ਹੀ ਕੀਤੇ ਨੇ ਅਤੇ ਕੁਝ ਮਨਪਸੰਦ ਅਨੁਭਵ ਵੀ ਕੀਤੇ ਨੇ ਜਿਸ ਕਾਰਨ ਮੈਨੂੰ ਬਾਈਕ ਚਲਾਉਣਾ